ਹਾਂਜੀ ਅੱਜ ਮੈਂ ਤੁਹਾਨੂੰ ਆਪਣੇ ਇੱਕ ਪ੍ਰੋਡਕਟ ਬਾਰੇ ਦੱਸਣਾ ਚਾਹੁੰਦੀ ਹਾਂ ਜੋ ਕਿ ਮੈਂ ਔਨਲਾਈਨ ਮੰਗਵਾਇਆ ਸੀ ਉਹ ਪ੍ਰੋਡਕਟ ਮੇਰੇ ਪੈੱਨ ਸੀ ਮੈਂ ਕੁਛ ਟਾਈਮ ਪਹਿਲਾਂ ਹੀ ਪੈੱਨ ਔਡਰ ਕਰੇ ਸੀ ਆਪਣੇ ਪੇਪਰਾਂ ਲਈ ਇਹ ਸੋਚ ਕੇ ਕਿ ਮੈਨੂੰ ਪੇਪਰ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਅਤੇ ਮੈਨੂੰ ਵਾਰ ਵਾਰ ਆਪਣੇ ਪੈੱਨ ਨਾ ਬਦਲਨੇ ਪੈਣ ਪਰ ਮੇਰੇ ਨਾਲ ਹੋਇਆ ਇੱਦਾਂ ਪਹਿਲਾਂ ਤਾਂ ਜੋ ਤਰੀਕ ਅਤੇ ਦਿਨ ਦੱਸਿਆ ਗਿਆ ਸੀ ਉਸ ਤੋਂ ਕਈ ਦਿਨ ਲੇਟ ਪਹੁੰਚੇ ਮੇਰੇ ਕੋਲ ਅਤੇ ਜਦੋਂ ਮੈਂ ਉਹ ਦੇਖੇ ਤਾਂ ਬਹੁਤ ਹੀ ਘਟੀਆ ਪੈਕਜਿੰਗ ਦੇ ਵਿੱਚ ਆਏ ਉਹਨਾਂ ਦੀ ਪੈਕਜਿੰਗ ਬਿਲਕੁਲ ਹੀ ਘਟੀਆ ਸੀ ਅਤੇ ਉਹਨਾਂ ਵਿੱਚੋਂ ਕੁਝ ਪੈਨ ਲੀਕ ਵੀ ਕਰ ਰਹੇ ਸਨ ਜਿਸ ਕਰਕੇ ਮੇਰੇ ਸਾਰੇ ਕੱਪੜੇ ਅਤੇ ਹੱਥ ਖ਼ਰਾਬ ਹੋ ਗਏ ਅਤੇ ਜਦੋਂ ਮੈਂ ਬਚੇ ਪੈੱਨ ਉਹਨਾਂ ਵਿੱਚੋਂ ਵਰਤ ਕੇ ਦੇਖੇ ਤਾਂ ਉਹ ਬਿਲਕੁਲ ਵੀ ਨਾ ਚੱਲੇ ਅਤੇ ਇਹ ਸਭ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ ਅਤੇ ਮੈਂ ਤਾਂ ਆਪਣੇ ਲਈ ਬੋਲ ਪੈੱਨ ਮੰਗਵਾਏ ਸੀ ਕਿਉਂਕਿ ਸਾਨੂੰ ਪੇਪਰਾਂ ਦੇ ਵਿੱਚ ਬੋਲ ਪੈੱਨ ਹੀ ਵਰਤਣ ਦੀ ਇਜ਼ਾਜ਼ਤ ਸੀ ਪਰ ਮੇਰੇ ਕੋਲ ਬੋਲ ਪੈੱਨ ਨਾ ਆਏ ਸਗੋਂ ਮੇਰੇ ਕੋਲ ਜੈਲ ਪੈੱਨ ਆਏ ਸੀ ਮੈਨੂੰ ਇਹ ਸਭ ਦੇਖ ਕੇ ਬਹੁਤ ਹੀ ਨਿਰਾਸ਼ਾ ਹੋਈ